ਹਾਂ ਮੈਨੂੰ ਵੀਡੀਓ ਗੇਮਸ ਬਾਰੇ ਪਤਾ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਮੇਰੀ ਮਨਪਸੰਦ ਗੇਮ ਬੈਡਲਗਰਾਊਂਡ ਹੈ ਅਤੇ ਹੋਰ ਵੀ ਕਈ ਵੀਡੀਓ ਗੇਮਸ ਮੈਂ ਖੇਡਦਾ ਹਾਂ ਜਿਹਨਾਂ 'ਚੋਂ ਅਰਫਿਡ ਨਾਇਨ ਗ੍ਰੈਂਡ ਅਡਰ ਦੀਫ ਫਾਈਵ ਫੋਰਟਨਾਈਟ ਮਾਰੀਓ ਕਾਰਟ ਟਰੱਕਰਸ ਓਫ ਯੂਰੋਪ ਅਮੈਰੀਕਨ ਟਰੱਕਰਸ ਇੱਦਾਂ ਦੀਆਂ ਕਈ ਗੇਮਾਂ ਖੇਡਦਾ ਹਾਂ ਮੈਂ ਪਰ ਕੁਛ ਗੇਮਾਂ ਇਹਨਾਂ 'ਚੋਂ ਮੈ ਰੋਜ਼ ਖੇਡਦਾ ਹਾਂ ਇਹ ਗੇਮਾਂ ਮੈਨੂੰ ਕਿਉਂ ਪਸੰਦ ਆ ਜਿੱਦਾਂ ਹੀ ਮੈਂ ਗੱਲ ਕਰਾਂ ਅਰਫਿਡ ਜਾਂ ਗ੍ਰੈਂਡ ਓਟੋ ਥੀਵ ਦੀ ਇਸ 'ਚ ਗਾਡ ਡਰਾਈਵਿੰਗ ਹੈ ਆਪਾਂ ਕਿਸੇ ਵੀ ਤਰ੍ਹਾਂ ਦਾ ਓਪਨ ਵਰਲਡ ਹੁੰਦਾ ਹੈ ਜਿਸ 'ਚ ਗੱਡੀ ਚਲਾ ਸਕਦੇ ਹਾਂ ਫੋਰਟਨਾਈਟ ਹੋ ਗਈ ਪੱਬਜੀ ਹੋ ਗਈ ਮਾਰੀਓ ਕਾਟ ਹੋ ਗਈ ਇਸ 'ਚ ਆਪਾਂ ਬੰਦਿਆਂ ਨਾਲ ਖੇਡਦੇ ਹਾਂ ਉਹਨਾਂ ਨੂੰ ਮਾਰਨਾ ਹੁੰਦਾ ਹੈ ਇਹ ਔਨਲਾਈਨ ਗੇਮ ਨੇ ਟਰੱਕਰਸ ਓਫ ਯੂਰੋਪ ਜਾਂ ਅਮੈਰੀਕਨ ਟਰੱਕਰਸ ਦੇ ਵਿੱਚ ਆਪਾਂ ਨੂੰ ਟਰੱਕ ਡਰਾਈਵਿੰਗ ਕਰਨੀ ਹੁੰਦੀ ਹੈ ਦੂਰ ਦੂਰ ਇਲਾਕਿਆਂ ਦੇ ਵਿੱਚ ਜਾਣਾ ਹੁੰਦਾ ਹੈ ਇਸ ਨਾਲ ਮੇਰਾ ਟਾਈਮ ਅੱਛਾ ਬੀਤਦਾ ਹੈ ਅਤੇ ਮੈਨੂੰ ਇਹ ਖੇਡ ਕੇ ਬਹੁਤ ਖੁਸ਼ੀ ਹੁੰਦੀ ਹੈ ਇਸ ਲਈ ਇਹ ਸਭ ਮੇਰੀਆਂ ਮਨਪਸੰਦੀਦਾ ਗੇਮ ਹਨ